ਹਾਂਜੀ ਹਾਂਜੀ ਸਰ ਹਾਂਜੀ ਸਾਹਿਬ ਬੋਲ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਾਹਿਬ ਹਾਂ ਹਾਂਜੀ ਹਾਂਜੀ ਹਾਂਜੀ ਜਾਣਦਾ ਜੀ ਮੈਂ ਬੂਟਾ ਸਿੰਘ ਨੂੰ ਮੇਰੇ ਦੋਸਤ ਦੇ ਅੱਗੇ ਦੋਸਤ ਨੇ ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸੋ ਦੱਸੋ ਠੀਕ ਹੈ ਜੀ ਹਾਂਜੀ ਹਾਂਜੀ ਜ਼ਰੂਰ ਮੋਸਟ ਵੈਲਕਮ ਜੀ ਦੇਖੋ ਜੀ ਇਸ ਤਰ੍ਹਾਂ ਹੁਣ ਇਸ ਵੇਲੇ ਦਸੰਬਰ ਚੱਲ ਰਿਹਾ ਇਸ ਵੇਲੇ ਤਾਂ ਬਹੁਤ ਸਰਦੀ ਹੈਗੀ ਹੈ ਇੱਥੇ ਠੰਡ ਹੈ ਹੈ ਨਾ ਜੀ ਪਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਵੀ ਤੁਸੀਂ ਅੱਗੇ ਨੈਕਸਟ ਈਅਰ ਮਾਰਚ ਦੇ ਵਿੱਚ ਆਉਣਾ ਉਸ ਵੇਲੇ ਜਿਹੜਾ ਮ ਮੌਸਮ ਹੈ ਬੜਾ ਸੁਹਾਵਣਾ ਹੋ ਜਾਂਦਾ ਕਿਉਂਕਿ ਨਾ ਬਹੁਤੀ ਗਰਮੀ ਹੁੰਦੀ ਹੈ ਅਤੇ ਨਾ ਬਹੁਤ ਠੰਡ ਅਤੇ ਵਧੀਆ ਰਹੇਗਾ ਤੁਸੀਂ ਅਗਰ ਮਾਰਚ ਵਿੱਚ ਆਉਂਦੇ ਆ ਅਗਰ ਮਾਰਚ ਤੋਂ ਵੀ ਥੋੜ੍ਹਾ ਪਹਿਲਾਂ ਆ ਜਾਂਦੇ ਤਾਂ ਹੋਰ ਵੀ ਜ਼ਿਆਦਾ ਵਧੀਆ ਰਹੇਗਾ ਹੁਣ ਹੁਣ ਤਾਂ ਜਿੱਦਾਂ ਤੁਹਾਨੂੰ ਮੈਂ ਦੱਸਿਆ ਇਸ ਵੇਲੇ ਪੂਰੀ ਠੰਡ ਹੈ ਇੱਥੇ ਅਤੇ ਬੜਾ ਠੰਡ ਦਾ ਮੌਸਮ ਹੈਗਾ ਆ ਅਤੇ ਇਹ ਇਹ ਅਤੇ ਇਹਨਾਂ ਦਿਨਾਂ ਦੇ ਵਿੱਚ ਦ ਦਸੰਬਰ ਦੇ ਵਿੱਚ ਪੰਜਾਬ ਬਹੁਤ ਠੰਡਾ ਹੋ ਜਾਂਦਾ ਜੇ ਬੰਬੇ ਦੇ ਮੁਕਾਬਲੇ ਦੇਖ ਇੱਥੇ ਜ਼ਿਆਦਾ ਠੰਡ ਹੁੰਦੀ ਹੈ ਅਤੇ ਵੈਸੇ ਜਿਸ ਤਰ੍ਹਾਂ ਤੁਸੀਂ ਪਲਾਨ ਕਰ ਰਹੇ ਵੀ ਤੁਸੀਂ ਅਗਲੇ ਨੈਕਸਟ ਈਅਰ ਆਉਣਾ ਆ ਜਿੱਦਾਂ ਤੁਸੀਂ ਕਹਿੰਦੇ ਮਾਰਚ ਵਿੱਚ ਤਾਂ ਉਹ ਬੈਸਟ ਰਹੇਗਾ ਵੀ ਹਾਲ ਦੀ ਘੜੀ ਠੰਡ ਬਹੁਤ ਆ ਉਸ ਵੇਲੇ ਮੌਸਮ ਵਧੀਆ ਹੁੰਦਾ ਜੀ ਹਾਂ ਹਾਂਜੀ ਹਾਂਜੀ ਨਹੀਂ ਤੁਹਾਡੇ ਬੰਬੇ ਤਾਂ ਫਿਰ ਸਮੁੰਦਰ ਦੇ ਕੰਢੇ ਤਾਂ ਵਧੀਆ ਇਸ ਕਰਕੇ ਉੱਥੇ ਹਾਂ ਹਾਂਜੀ ਹਾਂਜੀ ਅਸੀਂ ਵੀ ਖਬਰਾਂ 'ਚ ਸੁਣਦੇ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਰਹੇਗਾ ਉਹਨਾਂ ਦਿਨਾਂ 'ਚ ਹਾਂ ਬਾਕੀ ਬਸ ਹਾਂ ਜ਼ਰੂਰ ਜ਼ਰੂਰ ਜੀ ਮੋਸਟ ਵੈਲਕਮ ਤੁਸੀਂ ਆਉ ਜੇਕਰ ਮੇਰੇ ਲਾਇਕ ਕੋਈ ਵੀ ਸੇਵਾ ਹੋਵੇ ਤਾਂ ਦੱਸਣਾ ਜੀ ਠੀ ਠੀਕ ਆ ਸਤਿ ਸ਼੍ਰੀ ਅਕਾਲ ਜੀ